ਪੈਸੇ ਨੂੰ ਬਚਾਉਣ ਦੇ ਤਰੀਕੇ ਉਹਨਾਂ ਦੀ ਪ੍ਰੈਫਰੈਂਸ ਉਹਨਾਂ ਦੇ ਸੁਝਾਅ ਕੀ ਹੋ ਸਕਦੇ ਹੈ ਇਹਦੇ ਬਾਰੇ ਜੇ ਮੈਂ ਬੋਲਾਂ ਤਾਂ ਸਭ ਤੋਂ ਪਹਿਲਾਂ ਜੇ ਪੈਸੇ ਬਚਾਉਣ ਦੀ ਗੱਲ ਕਰਦੇ ਹਾਂ ਤਾਂ ਉਸ ਤੋਂ ਪਹਿਲਾਂ ਪੈਸੇ ਨੂੰ ਕਮਾਉਣ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਾਨੂੰ ਪੈਸੇ ਕਮਾਉਣ ਦੇ ਜੋ ਢੰਗ ਨੇ ਜਾਂ ਸਾਧਨ ਨੇ ਉਹ ਬਣਾਉਣੇ ਪੈਣੇ ਨੇ ਨੌਕਰੀ ਲਈ ਤਿਆਰ ਰਹਿਣਾ ਚਾਹੀਦਾ ਸੋਇਆ ਰੁਜ਼ਗਾਰ ਵਾਸਤੇ ਤਿਆਰ ਰਹਿਣਾ ਚਾਹੀਦਾ ਆਪਣੇ ਅੰਦਰ ਇਹ ਸਕਿਲਸ ਪੈਦਾ ਕਰੋ ਕਿ ਜਿਸ ਨਾਲ ਤੁਸੀਂ ਆਪਣੀ ਰੋਜ਼ੀ ਰੋਟੀ ਕਮਾ ਸਕਦੇ ਹੋ ਆਪਣੀ ਪਰਿਵਾਰ ਨੂੰ ਪਾਲ ਸਕਦੇ ਹੋ ਇੰਨਾ ਕੁ ਪੈਸਾ ਕਮਾਉਣ ਦੀ ਉਹ ਸਮਰਥ ਹੋਣੇ ਚਾਹੀਦੇ ਨੇ ਉਸ ਤੋਂ ਬਾਅਦ ਜੇ ਆਪਾਂ ਪੈਸਾ ਬਚਾਉਣ ਦੀ ਗੱਲ ਕਰੀਏ ਤਾਂ ਪੈਸਾ ਬਹੁਤ ਤਰੀਕਿਆਂ ਨਾਲ ਬਚਾਇਆ ਜਾ ਸਕਦਾ ਜਿਸ ਤਰ੍ਹਾਂ ਕਿ ਅਸੀਂ ਘਰਾਂ ਦੇ ਵਿੱਚ ਬੱਚੇ ਸਕੂਲ ਕਾਲਜ ਦੇ ਵਿੱਚ ਜਾਂ ਹੋਰ ਕਈ ਲੋਕ ਐਸ਼ ਓ ਆਰਾਮ ਮਨੋਰੰਜਨ ਕਰਨ ਦੇ ਲਈ ਪੈਸੇ ਨੂੰ ਫਜ਼ੂਲ ਖਰਚਦੇ ਹਨ ਉਹਨਾਂ ਤੋਂ ਵੀ ਅਸੀਂ ਪਰਹੇਜ਼ ਕਰ ਸਕਦੇ ਹਾਂ ਗੁਰੇਜ਼ ਕਰ ਸਕਦੇ ਹਾਂ ਪੈਸੇ ਨੂੰ ਫਾਲਤੂ ਖਰਚਣ ਤੋਂ ਅਸੀਂ ਬਚਾ ਸਕਦੇ ਹਾਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਸਾਡੇ ਕੋਲ ਕਿਹੜੀਆਂ ਕਿਹੜੀਆਂ ਪ੍ਰੈਫਰੈਂਸਸ ਨੇ ਸਜੈਸ਼ਨ ਨੇ ਜਾਂ ਤਰਜੀਹ ਹੈ ਕਿ ਪੈਸੇ ਨੂੰ ਕਿਵੇਂ ਬਚਾ ਸਕਦੇ ਹਾਂ ਜਿਵੇਂ ਸਭ ਤੋਂ ਪਹਿਲਾਂ ਐਫ ਡੀਜ ਦੀ ਗੱਲ ਕਰਦੇ ਹਾਂ ਆਪਾਂ ਫਿਕਸ ਡਿਪੋਜਿਟਸ ਦੀ ਤਾਂ ਉਹ ਵੀ ਇੱਕ ਬਹੁਤ ਬਿਹਤਰ ਤਰੀਕਾ ਹੈ ਕਿ ਬੈਂਕ ਸਾਨੂੰ ਇੱਕ ਫਿਕਸਡ ਜੋ ਹੈ ਟਾਈਮ ਪੀਰੀਅਡ ਲਈ ਇੱਕ ਫਿਕਸਡ ਇੰਟਰਸਟ ਦਿੰਦਾ ਹੈ ਤਾਂ ਤਾਂ ਉਹਨਾਂ ਚੀਜ਼ਾਂ ਦਾ ਵੀ ਸਾਨੂੰ ਫਾਇਦਾ ਉਠਾਉਣਾ ਚਾਹੀਦਾ ਹੈ ਕਿ ਇਹ ਐਫ ਡੀਜ ਅਸੀਂ ਬੈਂਕਸ ਦੇ ਵਿੱਚ ਵੀ ਕਰ ਸਕਦੇ ਹਾਂ ਅਲੱਗ ਅਲੱਗ ਜਿੰਨੇ ਵੀ ਸਾਡੇ ਕੋਲ ਨੈਸ਼ਨਲ ਜਾਂ ਸਟੇਟ ਬੈਂਕਸ ਨੇ ਉਹਨਾਂ ਦੇ ਵਿੱਚ ਆਪਾਂ ਐਫ ਡੀਸ ਅਕਾਊਂਟ ਨੇ ਜੋ ਉਹ ਬਣਾ ਸਕਦੇ ਹਾਂ ਅਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮਿਊਚੁਅਲ ਫੰਡਸ ਜੋ ਕਿ ਐਚ ਡੀ ਐਫ ਸੀ ਮੁਚੂਅਲ ਫੰਡਸ ਵੀ ਪ੍ਰੋਵਾਈਡ ਕਰਾਉਂਦੇ ਆ ਜਾਂ ਹੋਰ ਕੋਈ ਬੈਂਕਸ ਜਾਂ ਇਸ ਤਰ੍ਹਾਂ ਦੀ ਹੋਰ ਕੋਈ ਸਾਧਨ ਹਨ ਮਿਊਚੁਅਲ ਫੰਡਸ ਦੇ ਵਿੱਚ ਅਸੀਂ ਪੈਸਾ ਇਨਵੈਸਟ ਕਰ ਸਕਦੇ ਹਾਂ ਪਰ ਮਿਊਚੁਅਲ ਫੰਡਸ ਦੇ ਵਿੱਚ ਹੋਰ ਬਥੇਰੇ ਰਿਸਕ ਹੋ ਸਕਦੇ ਆ ਕਿ ਜਿਸ ਨਾਲ ਸਾਨੂੰ ਘਾਟਾ ਵੀ ਪੈ ਸਕਦਾ ਹੈ ਲੇਕਿਨ ਜੋ ਮਯੂਚੁਅਲ ਫੰਡ ਤੋਂ ਇਨਕਮੈਰਟਿਵ ਐਫ ਡੀਸ ਹੈ ਤਾਂ ਐਫ ਡੀਜ ਨੂੰ ਜ਼ਿਆਦਾ ਅਸੀਂ ਤਰਜੀਹ ਦੇ ਸਕਦੇ ਹਾਂ ਕਿਉਂਕਿ ਉਹਦੇ ਵਿੱਚ ਇੱਕ ਫਿਕਸ ਟਾਈਮ ਲਈ ਸਾਨੂੰ ਫਿਕਸਡ ਜੋ ਇੰਟਰਸਟ ਹੈ ਉਹ ਮਿਲਦਾ ਹੈ ਕਿ ਜਿਹੜੀ ਕਿ ਸਾਨੂੰ ਸ਼ੋਰਡ ਅਸ਼ੋਅਰਡ ਅਮਾਊਂਟ ਹੁੰਦੀ ਹੈ ਉਹ ਸਾਨੂੰ ਜਿਹੜੀ ਬੈਂਕ ਦੇ ਨੋਨਸ ਟਰਮਸ ਐਂਡ ਕੰਡੀਸ਼ਨ ਦੇ ਅਕੋਰਡਿੰਗ ਸਾਨੂੰ ਫਿਕਸ ਜੋ ਅਮਾਊਂਟ ਹੈ ਉਹ ਆਫਟਰ ਫਿਕਸ ਟਾਈਮ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਲੇਕਿਨ ਮਯੂਚੁਅਲ ਫੰਡਸ ਦੇ ਵਿੱਚ ਤੁਹਾਡੇ ਰਿਸਕ ਹੋ ਜਾਂਦੇ ਆ ਜਿਵੇਂ ਕਿ ਅਸੀਂ ਪੈਸਾ ਲਾਇਆ ਤਾਂ ਉਹ ਮਿਊਚੁਅਲ ਫੰਡਸ ਆਪਣੇ ਅੱਗੇ ਜੋ ਜਿਵੇਂ ਐਚ ਡੀ ਐਫ ਸੀ ਬੈਂਕ ਆ ਉਹ ਆਪਣੇ ਅੱਗੇ ਸ਼ੇਅਰ ਮਾਰਕੀਟ ਦੇ ਵਿੱਚ ਉਹ ਪੈਸਾ ਇਨਵੈਸਟ ਕਰਦੇ ਹੈ ਤਾਂ ਉਹਦੇ ਵਿੱਚ ਬੜੇ ਅਪ ਡਾਊਨਸ ਹੁੰਦੇ ਆ ਅਤੇ ਬੜੇ ਰਿਸਕ ਵੀ ਸਾਨੂੰ ਹੋ ਸਕਦੇ ਹੈ ਤਾਂ ਐਫ ਡੀਜ ਨੂੰ ਅਸੀਂ ਜ਼ਿਆਦਾ ਤਰਜੀਹ ਦੇਵਾਂਗੇ ਪੈਸੇ ਬਚਾਉਣ ਲਈ ਧੰਨਵਾਦ